ਮੈਂ ਨੀਟਿੰਗ ਕੋਰਨਰ ਚੈਨਲ ਨੂੰ ਫੋਲੋ ਕਰਦੀ ਹਾਂ ਅਤੇ ਸਭ ਨੂੰ ਇਹੀ ਸਲਾਹ ਦਊਂਗੀ ਕਿ ਨੀਟਿੰਗ ਕੋਰਨਰ ਚੈਨਲ ਨੂੰ ਹੀ ਫੋਲੋ ਕਰੋ ਕਿਉਂਕਿ ਇਸ 'ਤੇ ਸਿਖਾਈ ਜਾਣ ਵਾਲੀਆਂ ਚੀਜ਼ਾਂ ਬਹੁਤ ਹੀ ਸੌਖੇ ਤਰੀਕੇ ਨਾਲ ਸਿਖਾਈਆਂ ਜਾਂਦੀਆਂ ਹਨ ਮੇਰੇ ਬੱਚਿਆਂ ਲਈ ਅਤੇ ਮੈਂ ਆਪਣੇ ਬਜ਼ੁਰਗਾਂ ਲਈ ਇੱਥੋਂ ਹੀ ਚੀਜ਼ਾਂ ਸਿੱਖ ਕੇ ਬਣਾਉਂਦੀ ਹਾਂ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਮੈਂ ਮੇਰੇ ਕੋਲ ਇੱਕ ਦੁਕਾਨ ਵੀ ਹੈ ਜਿਸਦੀ ਜੋ ਮੇਰੀ ਸ਼ੌਂਕ ਪੂਰਾ ਕਰਨ ਨਾਲ ਨਾਲ ਮੇਰਾ ਕਮਾ ਕਮਾਈ ਦਾ ਜ਼ਰੀਆ ਵੀ ਬਣਿਆ ਹੋਇਆ ਹੈ ਅਤੇ ਇਸ ਕਰਕੇ ਹੀ ਮੈਨੂੰ ਇਹ ਚਾਹੁੰਦੀ ਹਾਂ ਕਿ ਲੋਕਾਂ ਨੂੰ ਵੀ ਇਸ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਦੇ ਸਕਾਂ ਕਿਉਂਕਿ ਸਰਦੀਆਂ ਵਿੱਚ ਇਸ ਦਾ ਕੰਮ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੁੰਦਾ ਹੈ ਜਿਸ ਕਰਕੇ ਲੋਕਾਂ ਦੀਆਂ ਡਿਮਾਂਡਸ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਇਹੀ ਗ ਇਹੀ ਮੇਰੀ ਇੱਛਾ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਮਿਲੇ